ਉਂਝ ਤਾਂ ਕਈ ਕਿਸਮ ਦੇ ਪੌਦੇ ਹੁੰਦੇ ਹਨ ਪੌਦੇ ਦੇ ਅਲੱਗ ਅਲੱਗ ਕਿਸਮਾਂ ਹੁੰਦੀਆਂ ਜਿਵੇਂ ਕਿ ਗੁਲਾਬ ਹੀ ਲਾ ਲਓ ਗੁਲਾਬ ਕਿੰਨੇ ਤਰ੍ਹਾਂ ਦਾ ਹੁੰਦਾ ਹੈਗਾ ਲਾਲ ਗੁਲਾਬ ਵੀ ਹੁੰਦਾ ਚਿੱਟਾ ਕਾਲਾ ਨੀਲਾ ਹਰਾ ਬਹੁਤ ਤਰ੍ਹਾਂ ਦੇ ਗੁਲਾਬ ਹੁੰਦੇ ਹਨ ਉਵੇਂ ਹੀ ਐਲੋਵੇਰਾ ਐਲੋਵੇਰਾ ਵੀ ਬਹੁਤ ਤਰ੍ਹਾਂ ਦੀ ਹੁੰਦੀ ਹੈ ਐਲੋਵੇਰਾ ਦੇ ਕਈ ਫਾਇਦੇ ਵੀ ਆ ਇਹਨਾਂ ਦਾ ਆਚਾਰ ਵੀ ਬਣਦਾ ਹੈਗਾ ਅਤੇ ਐਲੋਵੇਰਾ ਮੂੰਹ 'ਤੇ ਸਿਰ 'ਤੇ ਕਿੱਥੇ ਵੀ ਲਗਾ ਸਕਦੇ ਇਹਦੇ ਫਾਇਦੇ ਹੈ ਕਿ ਮੂੰਹ 'ਤੇ ਲਗਾਈ ਤਾਂ ਇਹਦੇ ਨਾਲ ਸਕਿਨ ਗਲੋਇੰਗ ਹੁੰਦੀ ਆ ਅਤੇ ਜੇ ਸਿਰ 'ਚ ਲਗਾਈਏ ਤਾਂ ਵਾਲ ਸਿਲਕੀ ਹੁੰਦੇ ਆ ਇਹਨਾਂ ਨੂੰ ਵਧਾਉਣ ਵਾਸਤੇ ਮਤਲਬ ਕਿ ਚੰਗੀ ਤਰ੍ਹਾਂ ਵਧਣ ਇਹ ਤਾਂ ਵਧੀਆ ਖੁਰਾਕ ਪਾਣੀ ਖਾਦ ਕੁਝ ਵੀ ਕਰ ਸਕਦੇ ਹੈਗੇ ਆ ਇਸ ਲਈ ਸਾਨੂੰ ਅੱਗੇ ਤੋਂ ਅੱਗੇ ਪੌਦੇ ਲਗਾਉਣ ਵੀ ਚਾਹੀਦੇ ਕਿਉਂਕਿ ਪੌਦਿਆਂ ਦਾ ਉਂਝ ਵੀ ਬਹੁਤ ਫਾਇਦਾ ਹੁੰਦਾ ਹੈ ਇਹ ਸਾਨੂੰ ਕੀ ਕਹਿੰਦੇ ਆ ਹਰਾ ਭਰਾ ਵਾਤਾਵਰਨ ਦਿੰਦੀ ਹੈ ਪਿੱਪਲ ਆਦਿ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਪਿੱਪਲ ਆਦਿ ਨਿੰਮ ਜਾਮਣ ਇੱਦਾਂ ਦੇ ਰੁੱਖ ਲਾਉਣੇ ਚਾਹੀਦੇ ਆ ਕਿਉਂਕਿ ਇਹ ਅੱਗੇ ਜਾ ਕੇ ਸਾਡੇ ਸਾਹ ਲੈਣ 'ਚ ਵੀ ਸਹਾਇਕ ਹੁੰਦੇ ਨੇ